ਕੋਈ ਵੀ ਵਿਅਕਤੀ ਗਾਣਾ ਗਾਉਣਾ ਸ਼ੁਰੂ ਕਰ ਸਕਦਾ ਹੈ ਗਾਣਾ ਗਾਉਣਾ ਸਭ ਤੋਂ ਪਹਿਲਾਂ ਸ਼ੁਰੂ ਕਰਨ ਵਾਸਤੇ ਉਸਨੂੰ ਆਪਣੇ ਗਲੇ ਦਾ ਰਿਆਜ਼ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਗਾਣਾ ਗਾਉਣਾ ਸ਼ੁਰੂ ਕਰਨ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਉਸ ਨੂੰ ਗਾਣੇ ਦੇ ਸੁਰ ਤਾਲ ਲੈਅ ਬਾਰੇ ਸਭ ਕੁਝ ਪਤਾ ਹੋਵੇ ਅਤੇ ਉਹ ਉਸਨੂੰ ਗਾਣਾ ਗਾਉਣ ਵਿੱਚ ਬਹੁਤ ਹੀ ਇੰਟਰਸਟ ਹੋਵੇ ਅਗਰ ਕਿਸੇ ਵੀ ਵਿਅਕਤੀ ਨੂੰ ਗਾਣੇ ਗਾਉਣ 'ਚ ਇੰਟਰਸਟ ਨਹੀਂ ਹੁੰਦਾ ਹੈ ਅਤੇ ਉਹ ਕਦੇ ਵੀ ਗਾਇਕ ਬਣ ਹੀ ਨਹੀਂ ਸਕਦਾ ਹੈ ਸਾਨੂੰ ਕਿਸੇ ਵੀ ਅਧਿਆਪਕ ਦੀ ਲੋੜ ਨਹੀਂ ਪੈਂਦੀ ਹੈ ਸਿੱਖਣ ਤੋਂ ਆਪਾਂ ਖੁਦ ਵੀ ਆਪਣੇ ਆਪ ਵੀ ਸਿੱਖ ਸਕਦੇ ਹਾਂ ਜਿਸ ਨੂੰ ਸਿੱਖਣ ਵਾਸਤੇ ਸਾਨੂੰ ਪਹਿਲਾਂ ਗਲੇ ਦਾ ਰਿਆਜ਼ ਕਰਨਾ ਚਾਹੀਦਾ ਹੈ ਸਵੇਰੇ ਉੱਠ ਕੇ ਸਾਰੇ ਗਾ ਮਾ ਪਾ ਧਾ ਨੀ ਸਾ ਇਸ ਨੂੰ ਚੰਗੀ ਤਰ੍ਹਾਂ ਨਾਲ ਰਿਆਜ਼ ਕਰਨਾ ਚਾਹੀਦਾ ਹੈ ਅਤੇ ਸਾਨੂੰ ਅੱਛਾ ਗਾਇਕ ਬਣਨ ਵਾਸਤੇ ਰੋਜ਼ ਰੋਜ਼ ਰਿਆਜ਼ ਕਰਨਾ ਚਾਹੀਦਾ ਹੈ ਇੱਕ ਦਿਨ ਵਾਸਤੇ ਨਹੀਂ ਅਗਰ ਆਪਾਂ ਰੋਜ਼ ਰੋਜ਼ ਕਰਾਂਗੇ ਤਾਹੀਓ ਆਪਾਂ ਵਧੀਆ ਤਰ੍ਹਾਂ ਨਾਲ ਗਾ ਸਕਦੇ ਹਾਂ ਅਤੇ ਆਪਾਂ ਇੱਕ ਵਧੀਆ ਗਾਇਕ ਬਣ ਸਕਦੇ ਹਾਂ ਜਿੰਨੇ ਵੀ ਸਾਡੇ ਮਹਾਨ ਗਾਇਕ ਆ ਆਪਾਂ ਕਿਸੇ ਦਾ ਵੀ ਨਾਮ ਲੈ ਲਈਏ ਅਰਿਜੀਤ ਸਿੰਘ ਹੋਵੇ ਜਾਂ ਕੋਈ ਵੀ ਇਹ ਫੀਮੇਲ ਹੋਵੇ ਕੋਈ ਵੀ ਔਰਤ ਹੋਵੇ ਉਹ ਗਾਣਾ ਗਾਉਂਦਾ ਇੱਦਾਂ ਹੀ ਨਹੀਂ ਸਿੱਖ ਜਾਂਦੇ ਹਨ ਉਹਨਾਂ ਨੇ ਬਹੁਤ ਸਾਲ ਪਹਿਲਾਂ ਦਾ ਉਹਨਾਂ ਦਾ ਰਿਆਜ਼ ਹੁੰਦਾ ਹੈ ਉਹਨਾਂ ਨੇ ਸਭ ਕੁਝ ਸਿੱਖਿਆ ਹੁੰਦਾ ਹੈ ਜਿਸ ਕਾਰਨ ਉਹ ਬਹੁਤ ਅੱਛੇ ਗਾਇਕ ਬਣਦੇ ਹਨ ਗਾਇਕ ਬਣਨਾ ਕੋਈ ਵੀ ਸੌਖੀ ਚੀਜ਼ ਨਹੀਂ ਹੈ ਇਸ ਲਈ ਸਾਨੂੰ ਪੂਰਾ ਪੂਰਾ ਪੂਰਾ ਪੂਰਾ ਧਿਆਨ ਦੇਣਾ ਚਾਹੀਦਾ ਹੈ ਕਿ ਸਾਨੂੰ ਇਹ ਕੰਮ ਕਿੱਦਾਂ ਕਰਨਾ ਹੈ ਅਤੇ ਸਾਨੂੰ ਇਸ ਵਿੱਚ ਪੂਰਾ ਇੰਟਰਸਟ ਲੈਣਾ ਚਾਹੀਦਾ ਹੈ ਤਾਹੀਓ ਆਪਾਂ ਕੰਮ ਕਰ ਸਕਦੇ ਹਨ